ਪੰਜਾਬੀ ਭਾਸ਼ਾ ਦੀ ਗੱਲ ਜਿੱਥੇ ਹਿੰਦੀ ਭਾਸ਼ਾ ਦੀ ਤੁਲਨਾ ਦੇ ਨਾਲ ਹੈ ਉਹ ਮੈਂ ਇਸ ਤਰ੍ਹਾਂ ਦੇਖਦਾਂ ਕਿ ਜਿਵੇਂ ਭਾਰਤ ਦੇ ਅੰਦਰ ਹਿੰਦੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਹਿੰਦੀ ਤੋਂ ਵੀ ਜਿਹੜੀ ਸੌਖੀ ਭਾਸ਼ਾ ਏ ਉਹ ਪੰਜਾਬੀ ਹੈ ਅਤੇ ਹਰ ਇੱਕ ਦੀ ਦਿਮਾਗ ਦੇ ਅੰਦਰ ਹਰ ਇੱਕ ਦੀ ਜੁਬਾਨ ਦੇ ਉੱਤੇ ਬੜੀ ਹੀ ਸੌਖੇ ਤਰੀਕੇ ਦੇ ਨਾਲ ਇਹ ਜਿਹੜੀ ਚੀਜ਼ ਹੈ ਬੋਲੀ ਜਾ ਸਕਦੀ ਹੈ ਈਵਨ ਕਿ ਇੱਥੋਂ ਤੱਕ ਕਿ ਇਹ ਲੋਕ ਇਹ ਜਿਹੜੀ ਸਾਡੀ ਪੰਜਾਬੀ ਭਾਸ਼ਾ ਏ ਇਹ ਕੁੱਲ ਸੰਸਾਰ ਦੇ ਵਿੱਚ ਬੋਲੀ ਜਾਂਦੀ ਹੈ